ਸਤਿ ਸ੍ਰੀ ਅਕਾਲ ਜੀ ਹੋਰ ਕੀ ਹਾਲ ਚਾਲ ਹੈ ਜੀ ਠੀਕ ਹੋ ਜੀ ਮੈਂ ਤੁਹਾਡੀ ਐਪ ਤੋਂ ਇੱਕ ਆਰਡਰ ਕੀਤਾ ਸੀ ਉਸ ਵਿੱਚ ਨਿਊਡਲਸ ਮੋਮੋਸ ਚੀਜ਼ ਚਿੱਲੀ ਕੋਲਡ ਡਰਿੰਕ ਮੰਗਵਾਈਆਂ ਸਨ ਮੇਰਾ ਆਰਡਰ ਹਾਲੇ ਤੱਕ ਨਹੀਂ ਪਹੁੰਚਿਆ ਮੈਂ ਪਿਛਲੇ ਇੱਕ ਘੰਟੇ ਤੋਂ ਵੇਟ ਕਰ ਰਿਹਾਂ ਇੱਕ ਘੰਟੇ ਤੋਂ ਤੁਹਾਡੀ ਐਪ ਪੰਦਰਾਂ ਮਿੰਟ ਹੀ ਦਿਖਾਈ ਜਾ ਰਹੀ ਹੈ ਮੈਨੂੰ ਦੋ ਘੰਟੇ ਹੋ ਚੁੱਕੇ ਹਨ ਆਰਡਰ ਕੀਤੇ ਹੋਏ ਨੂੰ ਮੈਂ ਮੇਰਾ ਆਰਡਰ ਹਾਲੇ ਤੱਕ ਨਹੀਂ ਪਹੁੰਚਿਆ ਮੇਰੇ ਘਰ ਮਹਿਮਾਨ ਆਏ ਹੋਏ ਹਨ ਮੈਂ ਹੁਣ ਖਾਣਾ ਵੀ ਨਹੀਂ ਤਿਆਰ ਕਰ ਸਕਦਾ ਅਤੇ ਮੇਰੀ ਵਾਈਫ ਬਿਮਾਰ ਹੈ ਅਤੇ ਉਹ ਉਸਦੇ ਬੇਬੀ ਹੋਣ ਵਾਲਾ ਹੈ ਇਸ ਲਈ ਉਹ ਕੁਝ ਤਿਆਰ ਨਹੀਂ ਕਰ ਸਕਦੀ ਸੋ ਕਿਰਪਾ ਕਰਕੇ ਪਤਾ ਕਰੋ ਮੇਰਾ ਆਰਡਰ ਹਾਲੇ ਤੱਕ ਕਿਉਂ ਨਹੀਂ ਪਹੁੰਚਿਆ ਜਾਂ ਡਿਲੀਵਰੀ ਬੋਆਏ ਨੂੰ ਪਤਾ ਕਰੋ ਵੀ ਆਰਡਰ ਕਿਉਂ ਨਹੀਂ ਪਹੁੰਚਿਆ ਹਾਲੇ ਤੱਕ ਜਾਂ ਫਿਰ ਏਦਾਂ ਕਰੋ ਆਪਣੀ ਫਰੈਂਚਾਈਜ਼ਸੀ ਦਾ ਨੰਬਰ ਦੇ ਦਿਉ ਮੈਂ ਉਹਨਾਂ ਨਾਲ ਗੱਲ ਕਰ ਕੇ ਪਤਾ ਕਰਾਂ ਵੀ ਆਰਡਰ ਕਿਉਂ ਨਹੀਂ ਪਹੁੰਚਿਆ ਸੋ ਕਿਰਪਾ ਕਰਕੇ ਮੇਰਾ ਆਰਡਰ ਜਲਦੀ ਤੋਂ ਜਲਦੀ ਪਹੁੰਚਾਉਣ ਦੀ ਕੋਸ਼ਿਸ਼ ਕਰੋ ਸੋ ਥੈਂਕ ਯੂ